ਮੈਂ ਸਮੇਂ ਦੇ ਅਨੁਸਾਰ ਚਲਦੀ ਹਾਂ ਕਈ ਵਾਰੀ ਮੈਂ ਤੇਲ ਪੇਂਟ ਜਾਂ ਵਾਟਰ ਕਲਰ ਵਰਗੇ ਰਵਾਇਤੀ ਮਾਧਿਅਮ ਨਾਲ ਕੰਮ ਕਰਨਾ ਪਸੰਦ ਕਰਦੀ ਹਾਂ ਜਾਂ ਕਈ ਵਾਰੀ ਮੈਂ ਡਿਜੀਟਲ ਕਲਾ ਵਰਗੀਆਂ ਨਵੀਆਂ ਤਕਨੀਕਾਂ ਦਾ ਪ੍ਰਯੋਗ ਵੀ ਕਰਦੀ ਹਾਂ ਜੇਕਰ ਮੇਰੇ ਕੋਲ ਵਧੇਰੇ ਸਮਾਂ ਹੁੰਦਾ ਹੈ ਤਾਂ ਮੈਂ ਹੱਥੀ ਪੇਂਟਿੰਗ ਕਰਦੀ ਹਾਂ ਪਰੰਤੂ ਜੇਕਰ ਮੇਰੇ ਕੋਲ ਸਮਾਂ ਘੱਟ ਹੁੰਦਾ ਹੈ ਤਾਂ ਮੈਂ ਡਿਜੀਟਲ ਕਲਾ ਦੀ ਵਰਤੋਂ ਕਰਦੀ ਹਾਂ ਜਿਸ ਨਾਲ ਮੇਰਾ ਕੰਮ ਹੋਰ ਵੀ ਜਿਆਦਾ ਆਸਾਨ ਹੋ ਜਾਂਦਾ ਹੈ ਅਤੇ ਮੈਨੂੰ ਕੋਈ ਇਸ ਵਿੱਚ ਦਿੱਕਤ ਮਹਿਸੂਸ ਨਹੀਂ ਹੁੰਦੀ